ਉੱਨੀ ਦਸ ਉੱਨੀ ਸੌ ਇਕਿਆਸੀ ਵੀਹ ਦਸ ਉੱਨੀ ਸੌ ਅੱਸੀ ਸੱਤ ਚਾਰ ਉੱਨੀ ਸੌ ਚੁਹੱਤਰ ਚਾਰ ਚਾਰ ਦੋ ਹਜ਼ਾਰ ਪੰਜ ਛੇ ਨੌ ਦੋ ਹਜ਼ਾਰ ਚਾਰ